ਹਾਂਜੀ ਅਸੀਂ ਜਿਹੜੇ ਪੌਦੇ ਘਰ ਚ ਲਗਾਏ ਹੁੰਦੇ ਆ ਉਹਨਾਂ ਤੋਂ ਹੋਰ ਪੌਦੇ ਅਸੀਂ ਤਿਆਰ ਕਰ ਸਕਦੇ ਹਾਂ ਆਸਾਨੀ ਦੇ ਨਾਲ ਹੀ ਜਦੋਂ ਦਾ ਬਹਾਰ ਹੁੰਦੀ ਆ ਅਤੇ ਮੌਸਮ ਦੇ ਹਿਸਾਬ ਨਾਲ ਉਹਨਾਂ ਤੋਂ ਕਲਮਾਂ ਜਿਹੜੀਆਂ ਤਿਆਰ ਕਰਕੇ ਹੋਰ ਪੌਦੇ ਤਿਆਰ ਕੀਤੇ ਜਾ ਸਕਦੇ ਆ ਅਤੇ ਇਸ ਨਾਲ ਕਿ ਆਪਾਂ ਨੂੰ ਪੈਸੇ ਵੀ ਆਪਣੇ ਖਰਚਣੋਂ ਬੱਚ ਜਾਂਦੇ ਆ ਅਤੇ ਆਪਾਂ ਹੋਰ ਇੱਕ ਪੌਦੇ ਤੋਂ ਕਈ ਪੌਦੇ ਤਿਆਰ ਕਰ ਸਕਦੇ ਹਾਂ ਜਿਵੇਂ ਹੁਣ ਕਈ ਜਿਹੜੇ ਪੌਦੇ ਹੁੰਦੇ ਆ ਉਹਨਾਂ ਦਾ ਜਿਵੇਂ ਤੁਲਸੀ ਹੋ ਗਈ ਉਹ ਵੀ ਆਪਣੇ ਤਿਆਰ ਹੋ ਜਾਂਦੇ ਇਹਨਾਂ ਉਹਦੇ ਬੀਜਾਂ ਤੋਂ ਫਿਰ ਕਲਮਾਂ ਤੋਂ ਅਸੀਂ ਪੌਦੇ ਤਿਆਰ ਕਰ ਲੈਂਦੇ ਹਾਂ ਅਤੇ ਉਹਨਾਂ ਵਧੀਆ ਇੰਨਾਂ ਵਾ ਵੀ ਹੋਰ ਆਪਾਂ ਪਲਾਂਟ ਤਿਆਰ ਕਰਦੇ ਹਾਂ ਜਿਹਦੇ ਨਾਲ ਕਿ ਵਧੀਆ ਨਾ ਘਰ ਬਾਹਰ ਜਿਸ ਨਾਲ ਲਗਾਏ ਹੁੰਦੇ ਆ ਉਹਨਾਂ ਤੋਂ ਕਈ ਫਾਇਦੇ ਵੀ ਹੁੰਦੇ ਆ ਜਿਵੇਂ ਤੁਲਸੀ ਵੀ ਜੇ ਆਪਾਂ ਚਾਹ 'ਚ ਪਾ ਸਕਦੇ ਹਾਂ ਉਸ ਤਰ੍ਹਾਂ ਵੀ ਖਾਣ ਲਈ ਵਧੀਆ ਹੁੰਦੀ ਆ ਕੜੀ ਪੱਤਾ ਹੋਇਆ ਸਬਜ਼ੀਆਂ ਸਵਾਦ ਬਣਾਉਣ ਲਈ ਕੜੀ ਪੱਤਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਜਿਸ ਨਾਲ ਆਪਾਂ ਨੂੰ ਕਿ ਬਾਹਰੋਂ ਬਾਜ਼ਾਰੋਂ ਇਹਨਾਂ ਸੁੱਕੇ ਪੌਦੇ ਜਿਹੜੇ ਓ ਜਿਸ ਤਰ੍ਹਾਂ ਹੁੰਦੇ ਆਪਾਂ ਨੂੰ ਦੇ ਬਾਜ਼ਾਰੋਂ ਮੰਗਵਾਉਣੇ ਪੈਂਦੇ ਹਨ ਉਹ ਆਪਾਂ ਘਰ 'ਚ ਇਹਨਾਂ ਵੀ ਨੂੰ ਸੁਕਾ ਕੇ ਪੌਦਿਆਂ ਨੂੰ ਤਿਆਰ ਕਰ ਸਕਦੇ ਹਾਂ ਆਪਾਂ ਸਬਜ਼ੀ ਆਦਿ 'ਚ ਵਰਤ ਸਕਦੇ ਹਨ